ਅੱਜ ਭਾਰਤ ਵਿੱਚ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈਗੀ ਹੈ ਬੇਰੁਜ਼ਗਾਰੀ ਦੀ ਹੈ ਕਿਉਂਕਿ ਜਿਹੜਾ ਅੱਜ ਦਾ ਯੂਥ ਹੈ ਉਹਨੂੰ ਸਮੇਂ ਸਿਰ ਨੌਕਰੀ ਜਾਂ ਪੜ੍ਹਾਈ ਦੇ ਲੈਵਲ ਨੌਕਰੀ ਉਹ ਬਿਲਕੁਲ ਭਾਰਤ ਵਿੱਚ ਨਹੀਂ ਮਿਲਦੀ ਤਾਂ ਕਿ ਤ ਤਾਂ ਜੋ ਕਿ ਜਿਹੜੇ ਬਾ ਪੰਜਾਬ ਦਾ ਜਾਂ ਭਾਰਤ ਦਾ ਯੂਥ ਹੈ ਉਹ ਬਾਹਰਲੇ ਕੰਟਰੀਆਂ ਨੂੰ ਮ ਰੁੱਖ ਕਰ ਰਿਹਾ ਉਹ ਤੋਂ ਬਾਅਦ ਦੂਜੀ ਸਮੱਸਿਆ ਹੈਗੀ ਆ ਟਰੈਫਿਕ ਦੀ ਟਰੈਫਿਕ ਦਾ ਕੋਈ ਰੂਲ ਰੈਗੂਲੇਸ਼ਨ ਹੈ ਹੀ ਨਹੀਂ ਹੈ ਸੜਕਾਂ ਬਹੁਤ ਬਣਾਈ ਜਾ ਰਹੇ ਹੈ ਪੂਰੇ ਇੰਡੀਆ ਦੇ ਵਿੱਚ ਸੜਕਾਂ ਦਾ ਜਾਲ ਵਿਛਾਤੇ ਆ ਪਰ ਰੂਲ ਰੈਗੂਲੇਸ਼ਨ ਦੀ ਕੋਈ ਵੈਲਿਊ ਨਹੀਂ ਹੈਗੀ ਉਹ ਤੋਂ ਬਾਅਦ ਸਮੱਸਿਆ ਬਹੁਤ ਜ਼ਿਆਦਾ ਜਿਹੜੀਆਂ ਬੱਸਾਂ ਦੇ ਵਿੱਚ ਲੇਡੀਜ਼ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਦੀ ਹੈ ਅਤੇ